ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਕੁੰਦਨ ਸਵੀਟ ਹਾਊਸ ਤੋਂ ਬੋਲਦੇ ਜੀ ਆ ਸਾਡੇ ਗੁਆਂਢ 'ਚ ਮਿਠਾਈ ਲੈ ਕੇ ਗਏ ਸੀ ਅਸੀਂ ਉਹਨਾਂ ਤੋਂ ਤੁਹਾਡਾ ਨੰਬਰ ਲਿਆ ਜੀ ਹਾਂਜੀ ਅਸੀਂ ਮਠਿਆਈ ਲੈਣੀ ਸੀ ਜੀ ਅਸੀਂ ਲੱਡੂ ਵਗੈਰਾ ਜੀ ਰਸਗੁੱਲੇ ਗੁਲਾਬ ਜਾਮਣਾ ਜੀ ਗਜਰੇਲਾ ਹੋਇਆ ਜੀ ਗਜਰੇਲਾ ਹੋਇਆ ਜੀ ਹਾਂਜੀ ਸਾਨੂੰ ਵਧੀਆ ਮਠਿਆਈ ਚਾਹੀਦੀ ਹੈ ਜੀ ਸਾਡੇ ਇੱਕ ਤਾਂ ਅਗੇਜਮੈਂਟ ਆ ਜੀ ਅਤੇ ਇੱਕ ਮੈਰਿਜ ਆ ਜੀ ਹਾਂਜੀ ਹਾਂਜੀ ਇਸ ਕਰਕੇ ਸਾਨੂੰ ਤੁਸੀਂ ਆਪਦਾ ਐਡਰੈਸ ਦੱਸ ਦਉਗੇ ਹਾਂਜੀ ਹਾਂਜੀ ਭਾਅ ਜੀ ਅਤੇ ਰੱਸਗੁਲੇ ਵਗੈਰਾ ਹੋ ਗਏ ਗਜਰੇਲਾ ਹੋ ਗਿਆ ਜੀ ਹਾਂਜੀ ਖੋਆ ਵਗੈਰਾ ਹੋ ਗਿਆ ਜੀ ਅਤੇ ਹੋਰ ਭਾਅ ਜੀ ਤੁਸੀਂ ਆਪਦਾ ਅਡਰੈੱਸ ਦੱਸ ਦਿਓ ਜੀ ਸਾਨੂੰ ਠੀਕ ਹੈ ਜੀ ਹਾਂਜੀ ਠੀਕ ਹੈ ਅਸੀਂ ਕੱਲ੍ਹ ਨੂੰ ਆਵਾਂਗੇ ਜੀ ਨਾਲੇ ਤਾਂ ਅਸੀਂ ਪੈਸਿਆਂ ਦੀ ਗੱਲ ਕਰ ਲਾਂਗੇ ਨਾਲੇ ਅਸੀਂ ਮਠਿਆਈ ਚੈਕ ਕਰ ਲਾਂਗੇ ਠੀਕ ਹੈ ਭਾਅ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਭਾਅ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਥੈਂਕ ਯੂ ਭਾਅ ਜੀ